ਮੈਂ ਦੌੜਦੇ ਸਮੇਂ ਇੱਕ ਵਾਰੀ ਸਲਿਪ ਕਰਕੇ ਧਰਤੀ 'ਤੇ ਡਿੱਗ ਗਿਆ ਅਤੇ ਜਿਸ ਕਾਰਨ ਮੇਰੇ ਗੋਡੇ 'ਤੇ ਸੱਟ ਲੱਗ ਗਈ ਅਤੇ ਉਸ ਕਾਰਨ ਮੈਂ ਦੋ ਮਹੀਨੇ ਬੈੱਡ 'ਤੇ ਰਿਹਾ ਅਤੇ ਉਸ ਤੋਂ ਬਾਅਦ ਮੈਂ ਠੀਕ ਹੋ ਕੇ ਫਿਰ ਦੌੜਨ ਲੱਗ ਪਿਆ ਫਿਰ ਸਰੀਰ ਜਿਹੜਾ ਦੋੜ ਕੇ ਹੀ ਫਿੱਟ ਹੁੰਦਾ ਹੈ ਕ ਕਸਰਤ ਕਰਨ ਨਾਲ ਹੀ ਫਿੱਟ ਹੁੰਦਾ ਹੈ